ਹਾਂਜੀ ਟੈਕਨੋਲਜੀ ਨੇ ਪੰਜਾਬ ਵਿੱਚ ਕਾਫ਼ੀ ਮਨੋਰੰਜਨ ਦ੍ਰਿਸ਼ ਪ੍ਰਭਾਵਿਤ ਕੀਤੇ ਹੀ ਹੋਏ ਆ ਅੱਜ ਕੱਲ੍ਹ ਜਿਵੇਂ ਫੋਨ 'ਤੇ ਹੀ ਤੁਹਾਨੂੰ ਹਰ ਹਰ ਚੀਜ਼ ਦਾ ਹੱਲ ਮਿਲ ਜਾਂਦਾ ਫੋਨ 'ਤੇ ਹੀ ਤੁਸੀਂ ਜੇ ਮੰਨ ਲਓ ਗਾਣੇ ਸੁਣਨਾ ਚਾਹੁੰਦੇ ਹੋ ਤਾਂ ਵਾਧੂ ਸਾਰੇ ਐਪ ਆ ਤੁਸੀਂ ਕੋਈ ਵੀ ਪੁਰਾਣੇ ਨਵੇਂ ਜਿਹੜੇ ਵੀ ਚਾਹੋ ਉਹ ਗਾਣੇ ਜਾਂ ਜਿਹੜੇ ਵੀ ਕਿਸੇ ਸਿੰਗਰ ਦੇ ਜਾਂ ਕੋਈ ਗਜ਼ਲ ਕੁਛ ਵੀ ਜੋ ਵੀ ਸੁਣਨਾ ਚਾਹੁੰਦੇ ਹੋ ਸੁਣ ਸਕਦੇ ਹੋ ਜਿਹੜੇ ਮਰਜ਼ੀ ਟਾਈਮ 'ਤੇ ਨਹੀਂ ਤਾਂ ਟੀ ਵੀ 'ਤੇ ਤਾਂ ਫਿਕਸ ਟਾਈਮ ਹੁੰਦਾ ਵੀ ਇਸ ਟਾਈਮ 'ਤੇ ਆਹ ਪ੍ਰੋਗਰਾਮ ਆਊਗਾ ਇਸ ਟਾਈਮ 'ਤੇ ਆਹ ਪ੍ਰੋਗਰਾਮ ਆਊਗਾ ਤੁਹਾਡੇ ਕੋਲ ਉਦੋਂ ਵੇਖਣ ਦਾ ਟਾਈਮ ਨਹੀਂ ਹੈਗਾ ਤਾਂ ਤੁਹਾਡਾ ਮਿਸ ਹੋ ਗਿਆ ਤਾਂ ਤੁਸੀਂ ਫੋਨ 'ਤੇ ਆਪਣਾ ਦੇਖ ਸਕਦੇ ਹੋ ਯੂਟੀਊਬ 'ਤੇ ਤੁਸੀਂ ਕੁਛ ਵੀ ਦੇਖ ਸਕਦੇ ਹੋ ਨੈਟਫਲਿਕਸ ਹੈਗਾ ਉਹਦੇ 'ਤੇ ਤੁਸੀਂ ਅੱਗੇ ਥਿਏਟਰ ਜਾਂਦੇ ਆਪਾਂ ਤਿੰਨ ਘੰਟੇ ਉੱਥੇ ਵੇਸਟ ਕਰਦੇ ਨਾਲੇ ਹੋਰ ਖਾਣੇ ਪੀਣੇ ਦਾ ਖ਼ਰਚਾ ਕਰਕੇ ਆਉਂਦੇ ਨੈਟਫਲਿਕਸ 'ਤੇ ਤੁਸੀਂ ਘਰ ਆਪਣਾ ਜਦੋਂ ਮਰਜ਼ੀ ਜਿਹੜੀ ਮਰਜ਼ੀ ਮੂਵੀ ਦੇਖੋ ਹਰੇਕ ਚੀਜ਼ ਤੁਹਾਨੂੰ ਮਤਲਬ ਫੋਨ 'ਤੇ ਘਰ ਬੈਠਿਆਂ ਹਾਜ਼ਰ ਹੋ ਜਾ ਜੂਗੀ ਹੋਰ ਵੀ ਬਹੁਤ ਕੁਝ ਦੇਖਦੇ ਚੀਜ਼ਾਂ ਤੁਹਾਡੇ ਨੇੜੇ ਹੀ ਹੁੰਦੀਆਂ ਪਰ ਤੁਹਾਨੂੰ ਟੈਕਨੋਲੋਜੀ ਰਾਹੀਂ ਪਤਾ ਲੱਗਦਾ ਜਿਵੇਂ ਹੁਣ ਆਹ ਬਠਿੰਡਾ ਕੋਲ ਇੱਕ ਪੰਨਫਨ ਵਾਟਰ ਪਾਰਕ ਬਣਿਆ ਹੈਗਾ ਅਤੇ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਅਤੇ ਉਹ ਸ਼ਾਇਦ ਕਈ ਲੋਕਾਂ ਨੂੰ ਨਾ ਵੀ ਪਤਾ ਹੋਵੇ ਪਰ ਹੁਣ ਫੋਨ 'ਤੇ ਉਹਨਾਂ ਦੀਆਂ ਇੰਨੀਆਂ ਵੀਡੀਓਜ਼ ਵਗੈਰਾ ਯੂਟੀਊਬ 'ਤੇ ਬਹੁਤ ਸਾਰੀਆਂ ਮਤਲਬ ਮੌਜ ਐਪ 'ਤੇ ਇੰਸਟਾ 'ਤੇ ਉਹਨਾਂ ਨੇ ਬਹੁਤ ਸਾਰੀਆਂ ਪਾ ਰੱਖੀਆ ਪੂਰਾ ਫੇਮਸ ਹੋ ਚੁੱਕਿਆ ਹੈਗਾ ਉਹ ਕਿ ਸਾਰੇ ਲੋਕ ਉੱਥੇ ਹੀ ਜਾ ਰਹੇ ਆ ਇਹ ਸਭ ਟੈਕਨੋਲੋਜੀ ਦੀ ਦੇਣੀ ਹੀ ਹੈਗੀ ਆ ਨਾ ਕਿ ਤੁਸੀਂ ਕੋਈ ਚੀਜ਼ ਬਾਰੇ ਮਤਲਬ ਜਾਣਦੇ ਹੋ ਫਿਰ ਇੱਕ ਜਿਵੇਂ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਹੈਗਾ ਨੇੜੇ ਉਹਦੇ ਬਾਰੇ ਵੀ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਫਿਰ ਉਹ ਮਤਲਬ ਆਹ ਟੈਕਨੋਲੋਜੀ ਰਾਹੀਂ ਇੰਨਾਂ ਫੇਮਸ ਹੋ ਗਿਆ ਕਿ ਉੱਥੇ ਇੰਨੀਆਂ ਜ਼ਿਆਦਾ ਭੀੜਾਂ ਲੱਗੀਆਂ ਹੁੰਦੀਆਂ ਕਿ ਮੱਥਾ ਟੇਕਣ ਨੂੰ ਤੁਹਾਡੀ ਵਾਰੀ ਨਹੀਂ ਆਉਂਦੀ ਉੱਥੇ ਅਤੇ ਐਤਵਾਰ ਵਾਲੇ ਦਿਨ ਵੀ ਉੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈਗਾ ਇਹ ਸਭ ਟੈਕਨੋਲਜੀ ਦੀ ਦੇਣ ਹੈ ਕਿ ਕਈ ਚੀਜ਼ਾਂ ਸਾਡੇ ਨੇੜੇ ਹੀ ਹੁੰਦੀਆਂ ਪਰ ਸਾਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਹੁੰਦਾ ਫਿਰ ਵੇਖ ਕੇ ਪਤਾ ਲੱਗਦਾ ਕਿ ਹਾਂ ਇਹ ਚੀਜ਼ ਵੀ ਸਾਡੇ ਨੇੜੇ ਹੈਗੀ ਸੀ